ਡਾਂਸ ਕਰਨਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਮੈਂ ਆਪਣੇ ਫ੍ਰੀ ਸਮੇਂ ਦੇ ਵਿੱਚ ਡਾਂਸ ਨੂੰ ਡਾਂਸ ਨੂੰ ਕਰਨਾ ਬਹੁਤ ਇੱਕ ਬੈਸਟ ਓਪਸ਼ਨ ਮੰਨਦੀ ਹਾਂ ਗਿੱਧਾ ਅਤੇ ਭੰਗੜਾ ਕਰਨਾ ਮੇਰਾ ਸਭ ਤੋਂ ਵੱਡਾ ਸ਼ੌਂਕ ਹੈ ਇਸਦੇ ਨਾਲ ਨਾਲ ਹੀ ਜਦੋਂ ਵੀ ਮੈਨੂੰ ਆਪਣੀ ਇਸ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਉਸ ਮੌਕੇ ਨੂੰ ਗਵਾਉਂਦੀ ਨਹੀਂ ਸਗੋਂ ਉਸ ਮੌਕੇ 'ਤੇ ਆਪਣਾ ਹੁਬ ਹੁਬਾ ਕੇ ਪ੍ਰਦਰਸ਼ਿਤ ਕਰਦੀ ਹਾਂ ਇਸ ਤਰ੍ਹਾਂ ਹੀ ਮੈਨੂੰ ਆਪਣੀ ਭੈਣ ਦੇ ਵਿਆਹ 'ਤੇ ਇਹ ਮੌਕਾ ਮਿਲਿਆ ਉੱਥੇ ਮੈਂ ਬਿਨ੍ਹਾਂ ਕਿਸੇ ਸੰਗ ਤੋਂ ਬਿਨ੍ਹਾਂ ਕਿਸੇ ਝਿਜਕ ਤੋਂ ਆਪਣਾ ਇਸ ਕਲਾ ਦਾ ਪ੍ਰਦਰਸ਼ਨ ਕੀਤਾ ਕਈ ਸਾਰਿਆਂ ਨੇ ਮੇਰੀ ਬਹੁਤ ਤਾਰੀਫ ਕੀਤੀ ਉਸ ਤੋਂ ਬਾਅਦ ਸਕੂਲ ਕੋਲੇਜ ਦੇ ਵਿੱਚ ਜਦੋਂ ਵੀ ਕੋਈ ਫੰਕਸ਼ਨ ਕਰਵਾਇਆ ਜਾਂਦਾ ਹੈ ਉਸ ਵਿੱਚ ਵੀ ਮੈਂ ਆਪਣਾ ਇਸ ਕਲਾ ਦਾ ਪ੍ਰਸਤੂਤੀਕਰਨ ਕਰਦੀ ਹਾਂ ਇਸਦੇ ਨਾਲ ਨਾਲ ਗਿੱਧਾ ਭੰਗੜਾ ਅਤੇ ਆਪਣਾ ਸੋਲੋ ਡਾਂਸ ਗਰੁੱਪ ਤਿਆਰ ਕਰਦੀ ਹਾਂ ਅਤੇ ਹੋਰ ਬੱਚਿਆਂ ਨੂੰ ਵੀ ਤਿਆਰ ਕਰਵਾਉਂਦੀ ਹਾਂ ਇਸਦੇ ਨਾਲ ਮੈਨੂੰ ਫਸਟ ਰੈਂਕ ਹਮੇਸ਼ਾ ਪ੍ਰਾਪਤ ਹੁੰਦਾ ਹੈ ਮੈਨੂੰ ਇਸ ਨਾਲ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ ਹੈ ਆਪਣੇ ਸਕੂਲ ਵਿੱਚ ਆਪਣੇ ਕੋਲੇਜ ਵਿੱਚ ਅਤੇ ਆਪਣੇ ਅ ਦੋਸਤਾਂ ਦੇ ਵਿੱਚ ਕਿ ਮੇਰਾ ਡਾਂਸ ਬਹੁਤ ਜ਼ਿਆਦਾ ਵਧੀਆ ਹੈ ਇਹ ਮੈਂ ਕਿਸੇ ਕੋਚਿੰਗ ਕਲਾਸਾਂ ਤੋਂ ਨਹੀਂ ਸਿੱਖਿਆ ਇਹ ਮੈਨੂੰ ਅੰਦਰੋਂ ਹੀ ਇੱਕ ਗੁਣ ਮਿਲਿਆ ਹੈ ਅਤੇ ਇਸ ਗੁਣ ਦੇ ਵਿੱਚ ਵਾਧਾ ਮੈਂ ਹੋਰ ਵੀਡੀਓਸ ਤੋਂ ਵੇਖ ਕੇ ਜਾਂ ਹੋਰ ਯੂਟਿਊਬ ਤੋਂ ਦੇਖ ਕੇ ਵਾਧਾ ਕੀਤਾ ਹੈ ਆਪਣੇ ਜਿਹੜੇ ਸਟੈਪ ਹੈ ਉਨ੍ਹਾਂ ਨੂੰ ਨਿਖਾਰਿਆ ਹੈ ਇਸ ਲਈ ਮੈਨੂੰ ਜਦੋਂ ਵੀ ਹ ਅੱਗੇ ਹੋਰ ਮੌਕੇ ਮਿਲਣਗੇ ਜਾਂ ਮੈਂ ਹੋਰ ਕਿਸੇ ਕੋਂਪੀਟੀਸ਼ਨ ਵਿੱਚ ਮੈਨੂੰ ਭਾਗ ਕਰਨ ਦਾ ਮੌਕਾ ਮਿਲਦਾ ਤਾਂ ਮੈਂ ਇਹ ਮੌਕਾ ਛੱਡਾਂਗੀ ਨਹੀਂ ਉਸ ਵਿੱਚ ਜ਼ਰੂਰ ਭਾਗ ਲਵਾਂਗੀ ਅਤੇ ਉਮੀਦ ਕਰਦੀ ਹਾਂ ਮੈਂ ਕਿ ਮੈਂ ਉੱਥੇ ਵੀ ਆਪਣਾ ਬੈਸਟ ਦਊਂਗੀ ਅਤੇ ਉੱਥੇ ਫਸਟ ਰੈਂਕ ਜ਼ਰੂਰ ਹਾਸਲ ਕਰਕੇ ਆਵਾਂਗੀ